ਸਾਡੇ ਖੇਤਰ ਵਿੱਚ ਇੱਕ ਕਾਲਜ ਬਣਿਆ ਹੋਇਆ ਹੈ ਜੋ ਕਿ ਜੀ ਐਨ ਡੀ ਯੂ ਦੇ ਅੰਦਰ ਆਉਂਦਾ ਹੈ ਉਸ ਤੱਕ ਆਉਣ ਲਈ ਬੱਚਿਆਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਾਡੇ ਇਲਾਕੇ ਵਿੱਚ ਆਉਣ ਲਈ ਕੋਈ ਵੀ ਟਰਾਂਸਪੋਰਟ ਦਾ ਸਹਾਰਾ ਬਹੁਤ ਹੀ ਮੁਸ਼ਕਲ ਨਾਲ ਹੀ ਮਿਲਦਾ ਹੈ ਇਸ ਕਰਕੇ ਬੱਚੇ ਕਈ ਕਈ ਕਿਲੋਮੀਟਰ ਚੱਲ ਕੇ ਕਾਲਜ ਤੱਕ ਪੁੱਜਦੇ ਹਨ ਔਰ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਸਾਡੇ ਇਲਾਕੇ ਵਿੱਚ ਟਰਾਂਸਪੋਰਟ ਦਾ ਸਾਧਨ ਬਣਾਇਆ ਜਾਏ ਤਾਂ ਕਿ ਲੋਕਾਂ ਨੂੰ ਕੋਈ ਵੀ ਆਉਣ ਜਾਣ ਵਿੱਚ ਕੋਈ ਵੀ ਮੁਸ਼ਕਲ ਨਾ ਹੋਏ ਔਰ ਸਾਡੇ ਇੱਧਰ ਹੋਰ ਵੀ ਕਈ ਧਾਰਮਿਕ ਸਥਾਨ ਹਨ ਜਿਹਨਾਂ ਵਿੱਚ ਲੋਕ ਆਪਣੇ ਹੀ ਸਾਧਨ ਕਰਕੇ ਆਉਂਦੇ ਹਨ ਅਤੇ ਮੈ ਇਹ ਕਹਿਣਾ ਚਾਹਾਂਗੀ ਕਿ ਸਾਡੇ ਸੈਲਾਨਿਆਂ ਨੂੰ ਆਕਾਰਸ਼ਿਤ ਕਰਨ ਨਈ ਇੱਕ ਤਾਂ ਟਰਾਂਸਪੋਰਟਸ ਨੂੰ ਵਧਾਇਆ ਜਾਏ ਔਰ ਦੂਸਰਾ ਉਹਨਾਂ ਦਾ ਪ੍ਰਚਾਰ ਕੀਤਾ ਜਾਏ ਕਿ ਸਾਡੇ ਇਲਾਕੇ ਵਿੱਚ ਇਹ ਵਾਲੀ ਸੈਲਾਨਿਆਂ ਲਈ ਇਹ ਵਾਲੀਆ ਚੀਜ਼ਾਂ ਪ੍ਰੈਜੈਂਟ ਹਨ ਤਾਂ ਕਿ ਲੋਕ ਇੱਥੇ ਆਉਣ ਦੀ ਇੱਛਾ ਜਤਾਉਣ